ਮੈਂ ਗੁਰਦਾਸਪੁਰ ਤੋਂ ਹਰਜੀਤ ਕੌਰ ਬੋਲਦੀ ਪਈ ਹਾਂ ਅਤੇ ਜਿਹੜਾ ਤਾਂ ਕਿਹੜੀਆਂ ਜਿਹੜੀਆਂ ਟੰਕਿਆਂ ਦਾ ਜਿਹੜਾ ਕੰਮ ਕਰਨਾ ਵਾ ਇਹ ਚੁਣੌਤੀਪੂਰਨ ਸੀ ਉਹਦੇ ਵਿੱਚ ਮੈਂ ਇੱਕ ਕੰਮ ਕੀਤਾ ਸੀ ਸਾੜੀ ਸਾੜੀ ਬਣਾਈ ਸੀ ਟੰਕਿਆਂ ਉਹਦੀ ਆਰੀ ਦੇ ਨਾਲ ਉਹਨੂੰ ਕਾਫੀ ਹੱਦ ਤੱਕ ਟਾਈਮ ਲੱਗ ਗਿਆ ਸੀ ਮਹੀਨਾ ਡੇਢ ਮਹੀਨਾ ਲੱਗ ਗਿਆ ਸੀ ਉਹਦੇ ਵਿੱਚ ਕਿ ਇੱਕ ਆਰੀ ਦਾ ਕੰਮ ਕੀਤਾ ਉਹਦੇ ਵਿੱਚ ਕੁਛ ਤਾਂਗੇ ਦਾ ਕੰਮ ਵੀ ਕੀਤਾ ਉਹਦੇ ਵਿੱਚ ਕੁਛ ਸਤਾਰਿਆਂ ਦਾ ਕੰਮ ਵੀ ਕੀਤਾ ਅਤੇ ਉਹ ਸਭ ਤੋਂ ਔਖਾ ਮਤਲਬ ਕਿ ਜ਼ਿਆਦਾ ਸੀ ਅਤੇ ਜਿਹੜਾ ਹੈਗਾ ਵਾ ਕਿ ਜਿਹੜਾ ਪਹਿਰਾਵਾ ਹੈਗਾ ਵਾ ਉਹ ਸਭ ਤੋਂ ਔਖਾ ਜਿਹੜਾ ਅੱਜ ਕੱਲ੍ਹ ਕੁੜੀਆਂ ਲਹਿੰਗਾ ਪਾਉਂਦੀਆਂ ਹੈਗੀਆਂ ਉਹ ਕੌਫੀਟੇਬਲ ਨਹੀਂ ਹੈਗਾ ਉਹਦਾ ਤਾਂ ਇੰਨਾ ਭਾਰ ਹੁੰਦਾ ਕਿ ਉਹ ਨਾ ਤਾਂ ਕੋਈ ਮਤਲਬ ਕਿ ਇੰਨਾ ਪਾ ਸਕਦਾ ਘਰ ਵਿੱਚ ਜਾਂ ਕਿਸ ਤਰ੍ਹਾਂ ਵੀ ਆ ਇਹ ਹੈ ਕਿ ਚਲੋ ਜਿਹੜਾ ਪਹਿਰਾਵਾ ਔਖਾ ਹੈਗਾ ਉਹ ਕਿਤੇ ਵਿਆਹ ਸ਼ਾਦੀ 'ਤੇ ਥੋੜ੍ਹਾ ਬਹੁਤਾ ਪਾਇਆ ਜਾ ਸਕਦਾ ਸਕਦਾ ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਸਭ ਤੋਂ ਜਿਹੜਾ ਅਸੀਂ ਕੰਮ ਕਰਦੇ ਹਾਂ ਘਰ ਵਿੱਚ ਆਰੀ ਦਾ ਕੰਮ ਕੀਤਾ ਸਿਲਾਈ ਕਢਾਈ ਸੂਟ ਜੋ ਵੀ ਆ ਉਹ ਸਾਨੂੰ ਥੋੜ੍ਹਾ ਜਿਹਾ ਮਤਲਬ ਕਿ ਆਸਾਨ ਲੱਗਦਾ ਸੀ ਜਿਹੜਾ ਹੈਗਾ ਸੀ ਆਰੀ ਦਾ ਕੰਮ ਜਿਹੜਾ ਕੱਢਣਾ ਸੀ ਪੱਤੀਆਂ ਤੀਲੇ ਦਾ ਕੰਮ ਸਾਰਾ ਉਹ ਕਾਫੀ ਹੱਦ ਤੱਕ ਔਖਾ ਕੰਮ ਸੀ ਅਤੇ ਬਾਕੀ ਉਹਨੂੰ ਕਾਫੀ ਸਮਾਂ ਮਤਲਬ ਕਿ ਲੱਗ ਗਿਆ ਡੇਢ ਕੁ ਮਹੀਨਾ ਉਹਨੂੰ ਲੱਗ ਗਿਆ ਕਿਉਂਕਿ ਜਿਹੜੀ ਸਾੜੀ ਸੀ ਉਹ ਕਾਫੀ ਪੰਜ ਸੱਤ ਮੀਟਰ ਦੀ ਪੰਜ ਦੀ ਹੁੰਦੀ ਆ ਅਤੇ ਉਹਨੂੰ ਹੌਲੀ ਹੌਲੀ ਕੱਢਦਿਆਂ ਕੱਢਦਿਆਂ ਕਾਫੀ ਉਹਨੂੰ ਟਾਈਮ ਲੱਗ ਗਿਆ ਵਾ ਅਤੇ ਹੋਰ ਸਭ ਤੋਂ ਔਖਾ ਤਾਂ ਮੈਨੂੰ ਉਹੋ ਲੱਗਾ ਵਾ ਜ਼ਿਆਦਾ ਜਿਹੜਾ ਲਹਿੰਗਾ ਹੈਗਾ ਵਾ ਅਤੇ ਬਾਕੀ ਇਹ ਹੈ ਕਿ ਚਲੋ ਜਿੰਨਾ ਬਾਕੀ ਸਿਲਾਈ ਕਢਾਈ ਜੋ ਵੀ ਸੂਟ ਸਿਊਣੇ ਜਾਂ ਸਲਵਾਰਾਂ ਬਣਾਉਣੀਆਂ ਜਾਂ ਬਲੋਜ ਬਣਾਉਣੇ ਉਹ ਥੋੜ੍ਹਾ ਮਤਲਬ ਕਿ ਸੌਖਾ ਜਿਹਾ ਕੰਮ ਸੀ ਉਹ ਤਾਂ ਚਲੋ ਜਲਦੀ ਮਤਲਬ ਹੋ ਜਾਂਦਾ ਵਾ ਬਾਕੀ ਹੈਗਾ ਕਿ ਜਿਹੜਾ ਕੰਮ ਸਿਲਾਈ ਕਢਾਈ ਦਾ ਸਵੈਟਰ ਬੁਣਨੇ ਉਹ ਵੀ ਥੋੜ੍ਹੇ ਮਤਲਬ ਕਿ ਟਾਈਮ 'ਤੇ ਲੱਗ ਜਾਂਦਾ ਵਾ ਪਰ ਚਲੋ ਬਣ ਜਾਂਦੇ ਆ ਪਰ ਹੁਣ ਚਲੋ ਦਸ ਪੰਦਰਾਂ ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਸਵੈਟਰ ਜਿਹੜੀ ਸਾੜੀ ਹੈਗੀ ਆ ਇਹਨੂੰ ਕਾਫੀ ਹੱਦ ਤੱਕ ਟਾਈਮ ਲੱਗ ਗਿਆ